ਮੈਂ ਬਹੁਤ ਵਧੀਆ ਤੈਰਾਕ ਹਾਂ ਇੱਕ ਹੈ ਮੈਨੂੰ ਮੈਂ ਜਦ ਅੱਠਵੀਂ ਵਿ ਅੱਠਵੀਂ ਕਲਾਸ ਵਿੱਚ ਸੀਗਾ ਪਰ ਮੈਨੂੰ ਮੇਰੇ ਤਾਏ ਦੇ ਮੁੰਡੇ ਨੇ ਬਹੁਤ ਵਧੀਆ ਤੈਰਾਕੀ ਸਿਖਾਈ ਸੀ ਪਰ ਇਹ ਉਸ ਤੋਂ ਬਾਅਦ ਮੈਂ ਪਾਣੀ ਦੇ ਵਿੱਚ ਡਿੱਗ ਗਿਆ ਪਰ ਮੇਰੇ ਤਾਏ ਦੇ ਮੁੰਡੇ ਨੇ ਬਹੁਤ ਵਧੀਆ ਹੀ ਮੇਰੀ ਸਹਾਇਤਾ ਕੀਤੀ ਆਖਰ ਵਿੱਚ ਆ ਕੇ ਪਰ ਮੇਰੇ ਤਾਏ ਦੇ ਮੁੰਡੇ ਨੇ ਮੈਨੂੰ ਤੈਰਾਕੀ ਸਿਖਾ ਹੀ ਦਿੱਤੀ ਇੱਕ ਉਸ ਤੋਂ ਬਾਅਦ ਮੈਂ ਤੈਰਾਕੀ ਸਿੱਖਣ ਤੋਂ ਬਾਅਦ ਅਤੇ ਮੈਂ ਬਹੁਤ ਸਾਰੇ ਲੋਕ ਡੁੱਬਦੇ ਹੋਏ ਵੇਖੇ ਪਰ ਮੈਂ ਬਹੁਤ ਸਾਰਿਆਂ ਲੋਕਾਂ ਦੀ ਜਾਨ ਵੀ ਬਚਾਈ ਹੈ ਮੇਰਾ ਪਿੰਡ ਦਰਿਆ ਦੇ ਨਾਲ਼ ਹੈ ਅਤੇ ਪਿਛਲੇ ਹਫ਼ਤੇ ਮੀਂਹ ਪਿਆ ਸੀ ਪਰ ਬਹੁਤ ਸਾਰੇ ਜਾਨਵਰ ਹੜ੍ਹ ਕੇ ਜਾਂਦੇ ਪਏ ਸੀਗੇ ਪਰ ਉਹਨਾਂ ਦੀ ਮੈਂ ਜਾਨ ਬਹੁਤ ਬਚਾਈ